ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ ਮੈਂ ਕੁਕਿੰਗ ਕਲਾਸਾਂ ਵੀ ਲੈਂਦੀ ਹਾਂ ਜਿਸ ਵਿੱਚ ਹਰ ਤਰ੍ਹਾਂ ਦੇ ਪਕਵਾਨ ਬਣਾਉਣ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਇਸ ਨੂੰ ਸਿੱਖਣ ਲਈ ਸ਼ੋਸ਼ਲ ਮੀਡੀਆ ਰਾਹੀਂ ਜਾਂ ਕੁਕਿੰਗ ਸਿਖਾਉਣ ਵਾਲੇ ਚੈਨਲਾਂ ਦੀ ਵੀ ਵਰਤੋਂ ਕਰਦੀ ਹਾਂ ਇਹਨਾਂ ਚੈਨਲਾਂ ਉੱਤੇ ਵੀ ਹਰ ਤਰ੍ਹਾਂ ਦੇ ਖਾਣਾ ਬਣਾਉਣ ਬਾਰੇ ਲੋਕ ਦੱਸਦੇ ਰਹਿੰਦੇ ਹਨ ਜਿਵੇਂ ਯੂਟਿਊਬ ਟੀ ਵੀ ਸ਼ੋਅ ਆਦਿ ਮੈਂ ਇਨ੍ਹਾਂ ਚੈਨਲਾਂ ਦੀ ਵਜ੍ਹਾ ਕਰਕੇ ਨਵੇਂ ਨਵੇਂ ਪਕਵਾਨ ਬਣਾਉਣੇ ਸਿੱਖੇ ਜਿਵੇਂ ਇਡਲੀ ਡੋਸਾ ਸਾਂਬਰ ਪੋਹਾ ਚਾਈਨੀਜ਼ ਫੂਡ ਆਦਿ